ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਦੇ ਹੋਰ ਰੂਪਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਜੇ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਗਿਆਰ੍ਹਵੀਂ ਸਦੀ ਵਿੱਚ ਗੋਰਖਨਾਥ ਦੇ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਇਸ ਦੋ ਅੱਗੇ ਚਲਦੀ ਲੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਹੋਰ ਜ਼ਿਆਦਾ ਵਿਸਤ੍ਰਿਤ ਕੀਤਾ ਅਤੇ ਆਪਣੀ ਬਾਣੀ ਦਾ ਸੰਕਲਨ ਕੀਤਾ ਅਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਅਪ ਪੂਰੇ ਪੈਂਤੀ ਅੱਖਰਾਂ ਨੂੰ ਸੁਧਾਰ ਕੇ ਇੱਕ ਨਵਾਂ ਰੂਪ ਦਿੱਤਾ ਅਤੇ ਉਸ ਨਾਲ ਹੀ ਆਪਣੀ ਬਾਣੀ ਦੀ ਰਚੀ ਅਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਰੂਪ ਆਦਿ ਗ੍ਰੰਥ ਉਸ ਵਿੱਚ ਬਾਣੀ ਦਾ ਸੰਕਲਨ ਕੀਤਾ ਅਤੇ ਉਸ ਨੂੰ ਸਾਏ ਕਵਿ ਕਵਿਤਾਵਾਂ ਰਾਗਾਂ ਵਿੱਚ ਵੰਡ ਕੇ ਉਸਦੀ ਸੰਰਚਨਾ ਕੀਤੀ ਅਤੇ ਅੱਗੇ ਚੱਲ ਕੇ ਹੋਰ ਵੀ ਪੰਜਾਬ ਕਲਾਕਾਰਾਂ ਨੇ ਵੀ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਿਵੇਂ ਮਿਰਜ਼ਾ ਸਾਹਿਬਾ ਸਸੀਂ ਪੁੰਨੂ ਅਤੇ ਹੋਰ ਹੋਰ ਵੀ ਕਈ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ ਅਤੇ ਸਾਡੇ ਜੋ ਅਜੋਕੇ ਸਮੇਂ ਵਿੱਚ ਮੌਜੂਦ ਹਨ ਜਿਵੇਂ ਉਸ ਸਮੇਂ ਦੇ ਕਲਾਕਾਰਾਂ ਨੇ ਪੀਲੂ ਦਮੋਦਰ ਅਤੇ ਹੋਰ ਵੀ ਕਈ ਕਾਲੇ ਵਾਰਿਸ ਸ਼ਾਹ ਬਹੁਤ ਜ਼ਿਆਦਾ ਮਸ਼ਹੂਰ ਹਨ ਅਤੇ ਇਹਨਾਂ ਨੇ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਹੁਤ ਜ਼ਿਆਦਾ ਸ਼ਲਾਘਾਯੋਗ ਕਦਮ ਪੁੱਟੇ